ਮੈਂ ਕੁਦਰਤੀ ਚੀਜ਼ਾਂ ਦਾ ਬੜਾ ਹੀ ਸ਼ੌਕੀਨ ਹਾਂ ਅਤੇ ਰੱਬ ਦੇ ਬਣਾਏ ਪੰਛੀਆਂ ਦਾ ਤੇ ਮੈਂ ਬਹੁਤ ਸ਼ੌਕੀਨ ਹਾਂ ਮੈਂ ਅਕਸਰ ਹੀ ਜਦੋਂ ਫਰੀ ਹੁੰਦਾ ਹਾਂ ਤਾਂ ਬਲਟਨ ਪਾਰਕ ਜਾਂ ਕੰਪਨੀ ਬਾਗ ਜਾਂ ਨਿੱਕੂ ਪਾਰਕ ਤੇ ਜਾਂਦਾ ਹਾਂ ਉੱਥੇ ਮੈਂ ਕਈ ਤਰ੍ਹਾਂ ਦੇ ਪੰਛੀ ਦੇਖਦਾ ਹਾਂ ਚਿੜੀਆਂ ਕਬੂਤਰ ਤੋਤੇ ਅਤੇ ਹੋਰ ਵੀ ਕਈ ਅਤੇ ਮੈਂ ਉਹਨਾਂ ਸਾਰਿਆਂ ਦੀਆਂ ਫੋਟੋਆਂ ਖਿੱਚ ਕੇ ਆਪਣੇ ਮੋਬਾਇਲ 'ਚ ਜਾਂ ਕਦੀ ਕਦੀ ਮੈਂ ਆਪਣੇ ਨਾਲ ਕੈਮਰਾ ਵੀ ਲੈ ਕੇ ਜਾਂਦਾ ਹਾਂ ਤੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਮੈਂ ਉਹ ਸਭ ਕੁਝ ਆਪਣੇ ਫੋਨ ਜਾਂ ਕੈਮਰਾ 'ਚ ਬੰਦ ਕਰ ਦਿੰਦਾ ਹਾਂ ਤੇ ਮੈਂ ਇਹਨਾਂ ਦੀਆਂ ਫਿਰ ਫੋਟੋਆਂ ਵੱਖ ਵੱਖ ਤਰ੍ਹਾਂ ਦੀਆਂ ਲਾ ਕੇ ਘਰ ਵਿੱਚ ਰੱਖਦਾ ਹਾਂ ਤਾਂ ਕਿ ਮੈਨੂੰ ਇਹ ਯਾਦ ਰਵੇ ਕਿ ਇਹ ਕੁਦਰਤੀ ਚੀਜ਼ਾਂ ਜਿਹੜੀਆਂ ਕਿ ਅਸੀਂ ਹੁਣ ਖਤਮ ਕਰ ਰਹੇ ਹਾਂ ਉਹਨੂੰ ਮੈਂ ਉਜਾਗਰ ਕਰ ਸਕਾਂ ਅਤੇ ਲੋਕਾਂ ਨੂੰ ਵੀ ਦੱਸ ਸਕਾਂ ਕਿ ਇਹ ਕੁਦਰਤੀ ਚੀਜ਼ਾਂ ਦਾ ਸਾਨੂੰ ਵੱਧ ਤੋਂ ਵੱਧ ਵਰਤੋਂ ਚ ਕੰਮ ਕਰਨਾ ਚਾਹੀਦਾ ਹੈ